ਹੈਲੋ ਹੈਲੋ ਹਾਂਜੀ ਸਰ ਯੋਗਾ ਇੰਸਟਰਕਸ਼ਨ ਬੋਲ ਰਹੇ ਸਰ ਮੈਨੂੰ ਆਹ ਮੇਰੇ ਦੋਸਤ ਨੇ ਇੱਕ ਨੰਬਰ ਦਿੱਤਾ ਸੀ ਤੁਹਾਡਾ ਕਿ ਤੁਸੀਂ ਯੋਗਾ ਬਾਰੇ ਦੱਸਦੇ ਹੋ ਅਤੇ ਮੈਂ ਪੁੱਛਣਾ ਚਾਹੁੰਦਾ ਕਿ ਹਾਊਸਵਾਈਫ ਦੇ ਯੋਗਾ ਬਾਰੇ ਤੁਸੀਂ ਦੱਸ ਸਕਦੇ ਹੋ

ਸਰ ਟਾਈਮਿੰਗ ਕੀ ਹੈ

ਬਾ ਠੀਕ ਹੈ

ਓ ਅੱਛਾ ਅੱਛਾ ਤਿੰਨ ਤੋਂ ਚਾਰ ਦਾ ਇਸ ਤੋਂ ਬਾਅਦ ਨਹੀਂ ਹੁੰਦਾ ਜੀ ਅੱਛਾ ਅੱਛਾ ਅੱਛਾ ਅੱਛਾ ਅੱਛਾ

ਅੱਛਾ ਅੱਛਾ ਅੱਛਾ ਜੀ ਅਤੇ ਆਪਣਾ ਇਹ ਆਪਣਾ ਕੋਈ ਡਿਸਕਾਉਂਟ ਵਗੈਰਾ ਅੱਛਾ ਅੱਛਾ ਜੀ ਅਤੇ ਸਰ ਅਡਰੈਸ ਕੀ ਆਪਣਾ ਭਲਾ ਹਾਂਜੀ ਕਪੂਰਥਲੇ ਠੀ ਠੀਕ ਹੈ ਜੀ ਹਾਂ ਵਿਜਿਟ ਉਹ ਉਹਦੇ ਉਹ ਤੋਂ ਉਨ੍ਹਾਂ ਤੋਂ ਪਤਾ ਲੱਗਾ ਨਾ ਮੈਨੂੰ ਤਾਹੀਂ ਮੈਂ ਤੁਹਾਡੇ ਨਾਲ ਕੋਲ ਕੀਤੀ ਨਾ

ਅੱਛਾ ਅੱਛਾ ਅੱਛਾ ਹਾਂਜੀ

ਠੀ ਠੀਕ ਹੈ ਜੀ ਠੀਕ ਹੈ ਜੀ ਅਤੇ ਆਪਣਾ ਸਰ ਤੁਹਾਨੂੰ ਮੈਂ ਕੋਲ ਕਰ ਦਊਂਗਾ ਇੱਕ ਦੋ ਦਿਨ 'ਚ ਅਤੇ ਇਹਦਾ ਔਨਲਾਈਨ ਵੀ ਔਨਲਾਈਨ ਵੀ ਫੋਮ ਭਰਿਆ ਜਾਂਦਾ ਆਪਣਾ ਇਹਦਾ ਠੀਕ ਹੈ ਜੀ ਠੀਕ ਹੈ ਸਰ